ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਅਤੇ ਤਰਨਤਾਰਨ ਹੈ ਜੀ ਸਾਰਾ ਨੈਟਵਰਕ ਚਲਦਾ ਜੀ ਇੱਥੋਂ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਸਕਦੇ ਜੀ ਬੜੇ ਆਰਾਮ ਨਾਲ ਅਤੇ ਗੋਇੰਦਵਾਲ ਸਾਹਿਬ ਜਾ ਸਕਦੇ ਜੇ ਇੱਥੋਂ ਤੁਸੀਂ ਪੱਟੀ ਮਖੂਵਾਲ ਏਰੀਏ 'ਚ ਵੀ ਜਾ ਸਕਦੇ ਜੇ ਫਿਰੋੋੋੋੋੋੋੋਜ਼ਪੁਰ ਤੱਕ ਵੀ ਚਲਦੀ ਟਰੇਨ ਇੱਧਰ ਸਾਰਾ ਨੈੱਟਵਰਕ ਘੇਰੇ ਘੇਰੇ ਚਲਦਾ ਜੀ ਆਪਣਾ ਪੂਰੇ ਸਾਰੇ ਏਰੀਏ ਜਿਲ੍ਹੇ ਨਾਲ ਕੰਡੈਕਟਿਡ ਆ ਹਾਂ ਅਤੇ ਤੁਸੀਂ ਆ ਜਾਉ ਬੜੀ ਕੋਈ ਮੁਸ਼ਕਿਲ ਨਹੀਂ ਆਊਗੀ ਤੁਹਾਨੂੰ ਬੜੀ ਸੁਖਾਲੀ ਯਾਤਰਾ ਹੋਏਗੀ ਤੁਹਾਡੀ ਸਾਰੀ ਹਾਂਜੀ ਹਾਂਜੀ ਜੇ ਹਾ ਹਾਂਜੀ ਹਾਂਜੀ ਇੱਥੋਂ ਜੇ ਤੁਸੀਂ ਅੰਮ੍ਰਿਤਸਰ ਦੀ ਤੜਕੇ ਦੀ ਚਾਰ ਵਜੇ ਦੀ ਟਰੇਨ ਵੀ ਚਲਦੀ ਆ ਇੱਕ ਅੱਠ ਵਜੇ ਫਿਰ ਚੱਲਦੀ ਆ ਅਤੇ ਦਸ ਵਜੇ ਪੱਟੀ ਨੂੰ ਚਲਦੀ ਆ ਇਕ ਬਾਰਾਂ ਵਜੇ ਚਲਦੀ ਪੱਟੀ ਨੂੰ ਫਿਰ ਮਖੂ ਨੂੰ ਚਲਦੀ ਸ਼ਾਮ ਦੇ ਟੈਮ ਇੱਕ ਸਵੇਰ ਦੇ ਟੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਆ ਜਿਓ ਜੀ ਜੀ ਆਇਆਂ ਨੂੰ